ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਭਾਅ ਜੀ ਤੁਹਾਡੀ ਨਾ ਗੱਡੀ ਬੁੱਕ ਕਰਵਾਈ ਸੀ ਓਲਾ ਵਾਲਿਆਂ ਦੀ ਪੀ ਬੀ ਛਿਆਲੀ ਸਤਾਈ ਇਕਆਸੀ ਉਹ ਕੀ ਗੱਲ ਹੋ ਗਈ ਅਜੇ ਤੱਕ ਡਰਾਈਵਰ ਆਇਆ ਹੀ ਨਹੀਂ ਹੈ ਅਗ ਅਸੀਂ ਮੈਰਿਜ 'ਤੇ ਜਾਣਾ ਸੀ ਮੰਮੀ ਸੀਗੇ ਮੇਰੇ ਮੇਰੇ ਨਾਲ ਲੜੀ ਜਾ ਰਹੇ ਬੱਚੇ ਕਾਹਲੇ ਪਏ ਆ ਅਸੀਂ ਵਿਆਹ 'ਤੇ ਪਹੁੰਚਣਾ ਸੀ ਟਾਈਮ ਦਿੱਤਾ ਹੋਇਆ ਸੀ ਅਜੇ ਤੱਕ ਆਇਆ ਹੀ ਨਹੀਂ ਹੈ ਇਹ ਕੋਈ ਵੈਸੇ ਤਰੀਕਾ ਨਹੀਂ ਹੈਗਾ ਇੱਦਾਂ ਨਹੀਂ ਚਾਹੀਦਾ ਕਿ ਕਿਸੇ ਨੂੰ ਖਰਾਬ ਕਰਨਾ ਕਮ ਸੇ ਕਮ ਤੁਸੀਂ ਦੱਸੋ ਤਾਂ ਸਹੀ ਇਹ ਕੀ ਗੱਲ ਆ ਕਿੱਥੇ ਆ ਪੰਜ ਮਿੰਟ ਪਹਿਲਾਂ ਮੇਰੀ ਉਹਨਾਂ ਨਾਲ ਗੱਲ ਹੋਈ ਕਹਿੰਦਾ ਭਾਅ ਜੀ ਮੈਂ ਆ ਗਿਆ ਆ ਗਿਆ ਪਰ ਅਜੇ ਤੱਕ ਤਾਂ ਪਹੁੰਚਿਆ ਨਹੀਂ ਪਰ ਨਾ ਐਤਕੀ ਇਸ ਗੱਲ ਦਾ ਮਜ਼ਾ ਨਹੀਂ ਹੈਗਾ ਇੱਦਾਂ ਨਹੀਂ ਕਿਸੇ ਨਾਲ ਕਰਨਾ ਚਾਹੀਦਾ ਪਰ ਨਾ ਹੁਣ ਮੈਂ ਬ ਰੱਦ ਹੀ ਕਰ ਦਿਓ ਤੁਸੀਂ ਗੱਡੀ ਹੁਣ ਨਹੀਂ ਮੈਂ ਅੱਗੇ ਤੋਂ ਬੁੱਕ ਕਰਵਾਉਂਦਾ ਦੂਜੀਆਂ ਬਹੁਤ ਕੰਪਨੀਆਂ ਹੈਗੀਆਂ